ਅੱਜ ਕੱਲ ਦੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਹਰ ਇੱਕ ਤਰੀਕੇ ਦੇ ਸਬਜੈਕਟ ਪੜ੍ਹਾਏ ਜਾਂਦੇ ਹਨ ਤਿੰਨ ਤਾਂ ਸਾਡੀਆਂ ਮੁੱਖ ਭਾਸ਼ਾਵਾਂ ਹੀ ਹੁੰਦੀਆਂ ਹਨ ਇੱਕ ਇੰਗਲਿਸ਼ ਇੱਕ ਹਿੰਦੀ ਅਤੇ ਇੱਕ ਪੰਜਾਬੀ ਜਿਹੜੀ ਕਿ ਪੰਜਾਬ ਦੇ ਵਿੱਚ ਮੇਨਲੀ ਪੜ੍ਹਾਏ ਜਾਂਦੇ ਹਨ ਅਤੇ ਅਸੀਂ ਬਾਕੀ ਸਬਜੈਕਟ ਬਾਰੇ ਵੀ ਜਾਣਾਂਗੇ ਇਹਦੇ ਵਿੱਚ ਮੈਥ ਸੋਸ਼ਲ ਸਾਇੰਸ ਸਾਇੰਸ ਅਤੇ ਆਦਿ ਸਪੋਰਟਸ ਵਰਗੇ ਸਬਜੈਕਟ ਹਨ ਜਿਹੜੇ ਕਿ ਸਾਨੂੰ ਕੋ ਸਕੂਲ ਦੇ ਵਿੱਚ ਲਗਾਏ ਜਾਂਦੇ ਹਨ ਸਾਡੇ ਸਕੂਲ ਦੇ ਵਿੱਚ ਅੱਠ ਤੋਂ ਨੌ ਤਰੀਕੇ ਦੇ ਵਿਸ਼ੇ ਪੜ੍ਹਾਏ ਜਾਂਦੇ ਹਨ ਅਤੇ ਸਾਰੇ ਅਧਿਆਪਕ ਪੜ੍ਹੇ ਲਿਖੇ ਅਤੇ ਐਜੂਕੇਟਡ ਹੁੰਦੇ ਹਨ ਜਿਹਦੇ ਕਰਕੇ ਕਿ ਸਾਨੂੰ ਹਰ ਇੱਕ ਚੀਜ਼ ਦੇ ਬਾਰੇ ਚੰਗੀ ਤਰ੍ਹਾਂ ਤਰੀਕੇ ਨਾਲ ਪਤਾ ਲੱਗਦਾ ਹੈ ਜੇ ਅਸੀਂ ਆਪਣੇ ਸਕੂਲ ਦੇ ਸਬਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਤਿੰਨ ਸਬਜੈਕਟ ਅੰਗਰੇਜ਼ੀ ਪੰਜਾਬੀ ਅਤੇ ਹਿੰਦੀ ਇਹ ਤਿੰਨ ਸਬਜੈਕਟ ਇਹੋ ਜਿਹੇ ਹਨ ਜਿਹੜੇ ਕਿ ਅੱਗੇ ਜਾ ਕੇ ਸਾਨੂੰ ਦੂਜਿਆਂ ਦੇ ਨਾਲ ਗੱਲਬਾਤ ਕਰਨ 'ਚ ਮਦਦ ਕਰਦੇ ਨੇ ਅਤੇ ਜੇ ਅਸੀਂ ਮੈਥ ਦੀ ਗੱਲ ਕੀਤੀ ਜਾਵੇ ਤਾਂ ਮੈਥ ਸਾਡੇ ਗਣਿਤ ਯਾਨੀ ਕਿ ਜਮਾ ਘਟਾਓ ਵਧਾਓ ਅਤੇ ਗੁਣਾ ਦੇ ਕਰਕੇ ਕੰਮ ਕਰਦੇ ਹਨ ਅਤੇ ਜੇ ਅਸੀਂ ਦੂਜੇ ਸਬਜੈਕਟਾਂ ਦੀ ਗੱਲ ਕਰੀਏ ਸੋਸ਼ਲ ਸਾਇੰਸ ਦੀ ਤਾਂ ਸੋਸ਼ਲ ਸਾਇੰਸ ਦੇ ਵਿੱਚ ਇਕਨੋਮਿਕਸ ਹਿਸਟਰੀ ਅਤੇ ਜਿਓਗਰਾਫੀ ਵਰਗੇ ਸ ਵਿਸ਼ੇ ਆਉਂਦੇ ਹਨ ਜਿਹਦੇ ਕਰਕੇ ਸਾਨੂੰ ਇਨ੍ਹਾਂ ਚੀਜ਼ਾਂ ਬਾਰੇ ਇੱਕ ਕੀ ਪਤਾ ਲੱਗਦਾ ਹੈ ਅਤੇ ਜੇ ਅਸੀਂ ਦੂਸਰੇ ਸਬਜੈਕਟ ਸਾਇੰਸ ਦੀ ਗੱਲ ਕਰੀਏ ਇਸ ਦੇ ਨਾਲ ਸਾਨੂੰ ਕੈਮੀ ਕੈਮਿਸਟਰੀ ਬਾਇਲੋਜੀ ਅਤੇ ਫਿਜਿਕਸ ਬਾਰੇ ਪਤਾ ਲੱਗਦਾ ਹੈ ਜਿਹਦੇ ਕਰਕੇ ਕਿ ਸਾਨੂੰ ਕੋਈ ਵੀ ਤਰੀਕੇ ਦਾ ਕੰਮ ਕਰਨ ਦੀ ਛਮਤਾ ਮਿਲਦੀ ਹੈ